ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਤੁਸੀਂ ਅਰਕ ਬੂਟੀਕ ਤੋਂ ਗੱਲ ਕਰ ਰਹੇ ਹੋ ਮੈਂ ਐਕਚੂਅਲੀ ਆਪਣੀ ਫ਼ਰੈਡ ਤੋਂ ਸੁਣਿਆ ਸੀ ਕੀ ਤੁਸੀਂ ਬਹੁਤ ਹੀ ਵਧੀਆ ਸੂਟ ਸਟਿੱਚ ਕਰਦੇ ਹੋ ਫੁਲਕਾਰੀ ਵਗੈਰਾ ਤਿਆਰ ਕਰਦੇ ਓ ਅਤੇ ਫਿਰ ਮੈਂ ਆਪਣੇ ਦੋ ਸੂਟ ਦੋ ਫੁਲਕਾਰੀਆਂ ਤੁਹਾਡੇ ਤੋਂ ਬਣਵਾਣੀਆਂ ਸੀ ਤੁਸੀਂ ਬਣਾ ਦੇਵੋਗੇ ਹਾਂ ਅਤੇ ਮੈਨੂੰ ਦੱਸ ਸਕਦੇ ਓ ਕਿ ਕਿੰਨੇ ਟਾਈਮ ਤੱਕ ਤੁਸੀਂ ਮੇਰੇ ਸੂਟ ਅਤੇ ਫੁਲਕਾਰੀ ਮੈਨੂੰ ਤਿਆਰ ਕਰਕੇ ਦੇ ਸਕਦੇ ਓ ਠੀਕ ਹੈ ਤੇ ਬਾਕੀ ਪੈਸੇ ਵਗੈਰਾ ਦਾ ਤੁਸੀਂ ਕਿੱਦਾਂ ਦੱਸੁਗੇ ਮੈਨੂੰ ਚਲੋ ਠੀਕ ਹੈ ਫਿਰ ਮੈਂ ਤੁਹਾਡੀ ਬੂਟੀਕ ਆਵਾਂਗੀ ਤੁਸੀਂ ਮੈਨੂੰ ਸਾਰਾ ਦੱਸ ਦਿਓ ਠੀਕ ਹੈ ਫਿਰ ਮੈਂ ਅੱਜ ਹੀ ਜਾਂ ਫਿਰ ਸਵੇਰੇ ਤੁਹਾਡੇ ਬੂਟੀਕ ਆਵਾਂਗੀ ਥੈਂਕ ਯੂ